ਹਾਂਜੀ ਮੈਂ ਦੱਸਣਾ ਚਾਹੁੰਦਾ ਮੇਰੇ ਨਾਲ ਕੋਈ ਵੀ ਇਹੋ ਜੀ ਅਣਹੋਣੀ ਘਟਨਾ ਹਲੇ ਤੱਕ ਨਹੀਂ ਵਾਪਰੀ ਹੈ ਜੇਕਰ ਭਵਿੱਖ ਵਿੱਚ ਇੱਦਾਂ ਦੀ ਕੋਈ ਘਟਨਾ ਹੁੰਦੀ ਵੀ ਹੈ ਮੇਰੇ ਸਾਹਮਣੇ ਜੋ ਦੇਖੇ ਮੈਂ ਦ ਮੈਂ ਦੇਖਣਾ ਚਾਹਵੇਗੀ ਤਾਂ ਮੈਂ ਉਹਨਾਂ ਦੀ ਹੈਲਪ ਜੋ ਹੈਲਪ ਕਰਨ ਲਈ ਜਾਵਾਂਗਾ ਅਤੇ ਮੈਂ ਉੱਥੇ ਉਹਨਾਂ ਦੀਆਂ ਫੋਟੋਆਂ ਵਗੈਰਾ ਕਲਿੱਕ ਨਹੀਂ ਕਰਾਂਗਾ ਅਤੇ ਨਾ ਹੀ ਕਿਤੇ ਪੋਸਟ ਕਰਾਂਗਾ ਸਗੋਂ ਉਹਨਾਂ ਦੀ ਹੈਲਪ ਕਰਾਂਗਾ